ਹੈਲੋ ਵਧੀਆ ਵਧੀਆ ਤੂੰ ਦੱਸ ਕਿਵੇਂ ਹੈ ਕੀ ਓਏ ਕਿਓਂ ਓਏ ਤੂੰ ਕੀ ਕਰਨੀ ਤੇਰੀ ਅ ਉਦੋਂ ਤਾਂ ਭੈ ਉਹ ਕਹਿੰਦਾਂ ਸੀ ਯਾਰ ਕਹਿੰਦਾ ਮੈਂ ਮ ਪ੍ਰੋਫੈਸਰ ਲੱਗਣਾ ਅੱਛਾ ਮੈਂ ਤਾਂ ਯਾਰ ਨਾ ਰੂੜਾ ਵਾਲਿਆਂ ਦੇ ਲੱਗਿਆ ਹੋਇਆ ਸੀ ਬਠਿੰਡੇ ਯਾਰ ਉਨ੍ਹਾਂ ਦੇ ਲੱਗਿਆ ਹੋਇਆ ਸੀ ਮੈਂ ਰੂੜਾ ਦੇ ਹੈਂ ਪੰਦਰਾਂ ਹਜ਼ਾਰ ਫੀਸ ਭਰਾਉਂਦੇ ਹੈ ਸਲੇਬਸ ਦਾ ਗੱਲ ਬਾਤ ਪੂਰੀ ਐਂਡ ਗੱਲ ਬਾਤ ਹੀ ਆ ਏ ਸੀ ਊਸੀ ਪੂਰਾ ਠੰਢਾ ਐਨ ਅਨੰਦਦਾਇਕ ਮਾਹੌਲ ਆ ਪੂਰਾ ਬਾਬੇ ਹਾਂ ਬੱਸ 'ਤੇ ਪੱਚੀ ਮਿੰਟਾਂ ਦਾ ਰਾਹ ਹੈਗਾ ਮਿੰਟ 'ਚ ਵਗ ਜਾਂਦੇ ਹਾਂ ਆਪਣੇ ਬਠਿੰਡੇ ਦਾ ਸਭ ਤੋਂ ਟੋਪ ਦਾ ਇੰਸਟੀਚਿਊਟ ਹੈ ਖਰਚਾ ਖੁਰਚਾ ਕੁਛ ਨਹੀਂ ਹੋਇਆ ਯਾਰ ਪਾਸ ਬਣਵਾ ਲੈਂਦੇ ਵਾ ਸਰਕਾਰੀ ਬੱਸ ਦਾ ਹਾਂ ਬਣਾਉਣਗੇ ਉਹ ਮਾਸਟਰ ਮੁਸਟਰ ਪੂਰੇ ਘੈਂਟ ਮੈਡਮਾਂ ਮੁਡਮਾਂ ਪੂਰੀਆਂ ਸਿਰਾ ਯਾਰ ਸਾਰੀਆਂ ਮਤਲਬ ਕਿ ਪੜ੍ਹਾਉਣ 'ਚ ਹਾਂ

ਵਰਦੀ ਮੈਂ ਕਹਿੰਦਾ ਤੈਨੂੰ ਲਾਹੁਣ ਹੀ ਨਹੀਂ ਦੇਣੀ ਜਾਣ ਸਾਰ ਹੀ ਪਵਾ ਦੇਣਗੇ ਵਰਦੀ ਮੈਂ ਕਹਿੰਦਾ ਤੂੰ ਜਦੋਂ ਲੱਗਣਾ ਹੋਇਆ ਤੂੰ ਪਹਿਲਾਂ ਨਾਪ ਦੇ ਕੇ ਵਰਦੀ ਦਾ ਫਿਰ ਹੀ ਲੱਗੀ ਯਾਰ ਪਹਿਲਾਂ ਹੁਣ ਤੂੰ ਆਏਂ ਕਰ ਤੂੰ ਪਹਿਲਾਂ ਕੱਲ੍ਹ ਨੂੰ ਵਰਦੀ ਦਾ ਨਾਪ ਦੇ ਆ ਫਿਰ ਲੱਗੀ ਫਿਰ ਤੂੰ ਉੱਥੇ ਦਾਖਲਾ ਭਰਾਈਂ ਇੰਨਾ ਤਕੜਾ ਹੈ ਹੋਰ ਠੀਕ ਹੈ ਊਂ ਯਾਰ ਉ ਮੈਂ ਤਾਂ ਉਨ੍ਹਾਂ ਦੇ ਲੱਗਿਆ ਸੀ ਊਂ ਯਾਰ ਦੂਜੇ ਵੀ ਵਧੀਆ ਨੇ ਹਾਂ ਹੋ ਗਿਆ ਰੁਪਿੰਦਰ ਸਿੱਧੂ ਵਾਲੇ ਵੀ ਵਧੀਆ ਨੇ ਊਂ ਤਾਂ ਪੁੜਾਨ ਕਿਡ

ਹਾਂ ਉਹ ਅੱਛਾ ਉਹ ਯੂ ਪੀ ਐੱਸ ਈ ਦੀ ਕਰੀ ਸੀ ਉਹਨੇ ਉਹ ਵੀ ਵਧੀਆ ਹਾਂ ਹਾਂ ਜੇ ਸਬ ਇੰਸਪੈਕਟਰ ਦੀ ਕਰਨੀ ਹੈ ਤਾਂ ਇਹੀ ਵਧੀਆ ਨੇ ਦੋਨੇ ਹਾਂ ਟੋਪ ਦੀ ਗੱਲ ਬਾਤ ਹੈ ਜਮਾਂ

ਹਾਂ ਭਰ ਦੇਈਂ ਕੋਈ ਨਾ ਆਪਾਂ ਨਾਲ ਆ ਜਾਈਂ ਕੋਈ ਨਾ ਆਪਾਂ ਬਹਿ ਕੇ ਕਰਦੇ ਗੱਲ ਫਿਰ ਅੱਛਾ ਚੰਗਾ ਡੈਮੋ ਡੁਮੋ ਇਨ੍ਹਾਂ ਦੇ ਹੁੰਦੇ ਆ ਬਸ ਸਟਾਟ ਹੀ ਆ ਤੈਨੂੰ ਚਾਰ ਦਿਨਾਂ ਦਾ ਡੈਮੋ ਦੁਆਣਗੇ ਪਹਿਲਾਂ ਚੰਗਾ ਹੈ